ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਲੋਕਡਾਊਨ ਦੇ ਵਿੱਚ ਘਰ ਰਹਿਣਾ ਸਾਰਿਆਂ ਦਾ ਬਹੁਤ ਹੀ ਔਖਾ ਹੋ ਗਿਆ ਸੀ ਅਤੇ ਖਾਣ ਪੀਣ ਦੀਆਂ ਚੀਜ਼ਾਂ ਦਾ ਬਜ਼ਾਰੋ ਮਿਲਣਾ ਵੀ ਸੰਭਵ ਨਹੀਂ ਸੀ ਇਸ ਕਰਕੇ ਮੈਂ ਅਤੇ ਮੇਰੀ ਭੈਣ ਨੇ ਆਪਣੇ ਘਰ ਦੇ ਵਿੱਚ ਹੀ ਬਹੁਤ ਸਾਰੀਆਂ ਚੀਜ਼ਾਂ ਬਣਾ ਬਣਾ ਕੇ ਖਾਧੀਆਂ ਜਿਵੇਂ ਕਿ ਅੱਜ ਕੱਲ੍ਹ ਦੇ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਅੱਜ ਕੱਲ੍ਹ ਘਰ ਬਿਲਕੁਲ ਫਰੀ ਰਹਿਣਾ ਬਿਲਕੁਲ ਵੀ ਪੋਸੀਬਲ ਨਹੀਂ ਹੈ ਤਾਂ ਮੈਂ ਤੇ ਮੇਰੀ ਭੈਣ ਨੇ ਬਹੁਤ ਸਾਰੀਆਂ ਚੀਜ਼ਾਂ ਘਰ ਹੀ ਬਣਾ ਕੇ ਖਾਧੀਆਂ ਜਿਵੇਂ ਕਿ ਬਰਗਰ ਪੀਜ਼ਾ ਚਾਟ ਗੋਲ ਗੱਪੇ ਮੋਮੋਜ ਫ੍ਰੈਂਚ ਫ੍ਰਾਈਸ ਕਚੋਰੀਆਂ ਬਰੈੱਡ ਰੋਲ ਸਮੋਸੇ ਅਤੇ ਹੋਰ ਵੀ ਕਾਫੀ ਚੀਜ਼ਾਂ ਸਨ ਜੋ ਕਿ ਅਸੀਂ ਘਰ ਬਣਾ ਕੇ ਟਰਾਈ ਕੀਤੀਆਂ ਅਤੇ ਜੇ ਅਤੇ ਜੋ ਵੀ ਅਸੀਂ ਘਰ ਬਣਾਉਂਦੇ ਸਾਂ ਪਹਿਲਾਂ ਪਹਿਲਾਂ ਤਾਂ ਉਹ ਨਹੀਂ ਸੀ ਬਣਦਾ ਕਿਉਂਕਿ ਬਾਹਰ ਵਾਲੀ ਜੋ ਗੱਲ ਹੈ ਉਹ ਨਹੀਂ ਘਰ ਬਣਦੀ ਪਰ ਜਦੋਂ ਇੱਕ ਦੋ ਵਾਰ ਅਸੀਂ ਫਿਰ ਟਰਾਈ ਕੀਤਾ ਤਾਂ ਉਹ ਬਹੁਤ ਵਧੀਆ ਬਣੀਆਂ ਉਹ ਟਾਈਮ ਮੇਰੇ ਲਈ ਬਹੁਤ ਹੀ ਸਪੈਸ਼ਲ ਸੀ ਲੋਕਡਾਊਨ ਵਾਲਾ ਪਰ ਉਸ ਟਾਈਮ ਵਿੱਚ ਔਖ ਵੀ ਬਹੁਤ ਸੀ ਪਰ ਆਪਾਂ ਕਾਫੀ ਸਾਰੀਆਂ ਚੀਜ਼ਾਂ ਘਰ ਬਣਾ ਕੇ ਖਾਧੀਆਂ ਸੀ